ਜਿਹੜਾ ਸੋਸ਼ਲ ਮੀਡੀਆ ਹੈ ਉਹ ਬਹੁਤ ਹੀ ਜ਼ਿਆਦਾ ਅੱਜ ਕਲ੍ਹ ਦੇ ਲੋਕਾਂ ਦੇ ਵਿੱਚ ਟਰੈਂਡ ਵਿੱਚ ਆ ਗਿਆ ਹੈ ਅਤੇ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰ ਰਹੇ ਨੇ ਅਤੇ ਆਪਣੀਆਂ ਪੋਸਟਾਂ ਵੀ ਪਾਉਂਦੇ ਨੇ ਆਪਣੇ ਤਸਵੀਰਾਂ ਵੀ ਪਾਉਂਦੇ ਨੇ ਅਤੇ ਮੈਂ ਜਿਹੜੀ ਹੈਗੀ ਹਾਂ ਉਹ ਮੈਂ ਸੋਸ਼ਲ ਮੀਡੀਆ ਦਾ ਇਸਤੇਮਾਲ ਤਾਂ ਕਰਦੀ ਹਾਂ ਪਰ ਮੈਂ ਉਹਦੇ 'ਤੇ ਆਪਣੀਆਂ ਪੋਸਟਾਂ ਯਾ ਤਸਵੀਰਾਂ ਨਹੀਂ ਪਾਉਂਦੀ ਕਿਉਂਕਿ ਮੈਨੂੰ ਇਹ ਚੀਜ਼ ਠੀਕ ਨਹੀਂ ਲੱਗਦੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਤਸਵੀਰਾਂ ਨੇ ਉਹ ਆਪਣੀਆਂ ਯਾਦਾਂ ਨੂੰ ਆਪ ਸੰਜੋਅ ਕੇ ਰੱਖਣ ਵਾਸਤੇ ਹੁੰਦੀਆਂ ਨਾ ਕਿ ਲੋਕਾਂ ਨੂੰ ਦਿਖਾਉਣ ਵਾਸਤੇ ਅਤੇ ਮੈਨੂੰ ਇਹ ਚੀਜ਼ ਪਸੰਦ ਨਹੀਂ ਹੈਗੀ ਇਸ ਲਈ ਮੈਂ ਇਹ ਸਭ ਨਹੀਂ ਕਰਦੀ